ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸੈਂਟਰ ਯੂਨੀਵਰਸਿਟੀ ਤੋਂ ਬੋਲਦੇ ਆ

ਹਾਂਜੀ ਠੀਕ ਹੈ ਜੀ ਹਾਂਜੀ ਦੱਸੋ ਕੁਛ ਪੁੱਛਣਾ ਚਾਹੁੰਦੇ ਹੋ ਅਤੇ ਇਹ ਮੈਡਮ ਬਾਦਲ ਰੋਡ 'ਤੇ ਘੁੱਦਾ ਪਿੰਡ ਹੈਗਾ ਅ ਬਠਿੰਡਾ ਤੋਂ ਤੇਈ ਕਿਲੋਮੀਟਰ ਦੂਰ ਹੈ ਉੱਥੇ ਬਣੀ ਹੋਈ ਹੈ ਇਹ ਇਹ ਮੈਡਮ ਪੰਜ ਸੌ ਕਿੱਲੇ 'ਚ ਫੈਲੀ ਹੋਈ ਆ ਇਹ 'ਚ ਮਤਲਬ ਅਲੱਗ ਅਲੱਗ ਬਿਲਡਿੰਗਾਂ ਹੈਗੀਆਂ ਜਿਵੇਂ ਅਕੈਡਮਿਕ ਬਣੀ ਹੋਈ ਹੈ ਲਾਈਬ੍ਰੇਰੀ ਦੀ ਅਲੱਗ ਬਿਲਡਿੰਗ ਹੈ ਉਹਦੇ ਇੱਕ ਹੋਸਟਲ ਹੈ ਵਿੱਚ ਅਤੇ ਰੈਜੀਡੈਂਸ਼ਅਲ ਏਰੀਆ ਵੀ ਹੈਗਾ ਇਹਦੇ 'ਚ ਹਾਂਜੀ ਇਹ ਦੋ ਹਜ਼ਾਰ ਵੀਹ 'ਚ ਸ਼ਿਫਟ ਹੋਈ ਹੈ ਇੱਥੇ ਵੈਸੇ ਤਾਂ ਯੂਨੀਵਰਸਿਟੀ ਦੋ ਹਜ਼ਾਰ ਨੌ ਤੋਂ ਮਤਲਬ ਆਈ ਹੋਈ ਆ ਅਤੇ ਪਰ ਮਤਲਬ ਇਹ ਪਹਿਲਾਂ ਬਠਿੰਡੇ ਹੀ ਸੀਗੀ ਰੈਂਟ 'ਤੇ ਬਿਲਡਿੰਗ ਹੁਣ ਇਹ ਸ਼ਿਫਟ ਹੋਈ ਆ ਇੱਥੇ ਦੋ ਹਜ਼ਾਰ ਵੀਹ ਹਾਂਜੀ ਹਾਂਜੀ ਬੱਚਿਆਂ ਵਾਸਤੇ ਹੋ ਹੋਸਟਲ ਬਣੇ ਹੋਏ ਆ ਸਾਰੇ ਬੱਚੇ ਮਤਲਬ ਇੱਥੇ ਅੰਦਰ ਹੀ ਰਹਿੰਦੇ ਹੈਗੇ ਜਿਹੜੇ ਵੀ ਜਿਹਨਾ ਦੀ ਵੀ ਐਡਮਿਸ਼ਨਾਂ ਹੁੰਦੀਆਂ ਹੈਗੀਆਂ ਅਤੇ ਬਹੁਤ ਵਧੀਆ ਮਤਲਬ ਇੱਥੇ ਇਹ ਕੰਮ ਬੱਚੇ ਪੀ ਐੱਚ ਡੀ ਵਗੈਰਾ ਕਰਦੇ ਹੈਗੇ ਬਹੁਤ ਵਧੀਆ ਹੈਗਾ ਹਾਂਜੀ ਮੈਮ ਹਾਂਜੀ ਹਾਂਜੀ ਹਾਂ ਬਾਹਰੋਂ ਜੇ ਕੋਈ ਆਵੇ ਗੈਸਟ ਹਾਊਸ ਬਹੁਤ ਵਧੀਆ ਬਣਿਆ ਹੋਇਆ ਬਹੁਤ ਵਧੀਆ ਸਰਵਿਸ ਕੀਤੀ ਜਾਂਦੀ ਇੱਥੇ ਬਹੁਤ ਵਧੀਆ ਬਣਾਇਆ ਹੋਇਆ ਉਹ ਵੀ ਬਿਲਡਿੰਗ ਉਹਦੀ ਗੈਸਟ ਹਾਊਸ ਦੀ ਵੀ ਹਾਂਜੀ ਮੈਮ ਅ ਬੱਚਿਆਂ ਲਈ ਤਾਂ ਬੱਚਿਆਂ ਲਈ ਤਾਂ ਵੈਨ ਲਗੀ ਹੋਈ ਹੈ ਯੂਨੀਵਰਸਿਟੀ ਦੀ ਹੀ ਆ ਅਤੇ ਬਾਕੀ ਅ ਲੋਕ ਆਪਣੇ ਪਰਸਨਲ ਵੀਕਲ 'ਤੇ ਵੀ ਜਿਵੇਂ ਆਉਣ ਜਾਣ ਦਾ ਕਰ ਲੈਂਦੇ ਹੈਗੇ ਅਤੇ ਪਰ ਵੈਨ ਫਸੀਲਟੀ ਹੈਗੀ ਜੇ ਵੈਨ ਅ ਨਾ ਵੀ ਹੋਵੇ ਤਾਂ ਬਾਹਰੋਂ ਵੀ ਮਤਲਬ ਪਿੰਡ 'ਚੋਂ ਸ਼ਹਿਰ ਵੱਲ ਨੂੰ ਬਸਾਂ ਬਹੁਤ ਮਤਲਬ ਪ੍ਰਾਈਵੇਟ ਸਰਵਿਸ ਵੀ ਬਹੁਤ ਹੇਗੀ ਹੈ ਹਾਂਜੀ ਠੀਕ ਹੈ ਮੈਮ ਠੀਕ ਹੈ ਜ਼ਰੂਰ ਠੀਕ ਥੈਂਕਯੂ ਓਕੇ ਓਕੇ ਜੀ